ਛੱਬੀ ਮਾਰਚ ਦੋ ਹਜ਼ਾਰ ਚੌਵੀ ਪੰਜ ਅਕਤੂਬਰ ਦੋ ਹਜ਼ਾਰ ਚੌਵੀ ਪੰਜ ਅਗਸਤ ਦੋ ਹਜ਼ਾਰ ਚੌਵੀ ਦਸ ਅਗਸਤ ਦੋ ਹਜ਼ਾਰ ਚੌਵੀ ਐਂਡ ਤੇਰ੍ਹਾਂ ਅਗਸਤ ਦੋ ਹਜ਼ਾਰ ਚੌਵੀ